ਸਿੱਖਿਆ 'ਤੇ ਪੋਹਚ ਪਹੁੰਚ ਕਰਨ ਲਈ ਦੌਰਾਨ ਬੱਚਿਆਂ ਵਿੱਚ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਵੀ ਕਿ ਸਾਡੇ ਜਿਹੜੇ ਅੱਛੇ ਲ ਸਕੂਲ ਨੇ ਜਾਂ ਸਾਡੇ ਅੱਛੇ ਕੋਲਜ ਯੂਨੀਵਰਸਿਟੀ ਹੈ ਉਹ ਬੱਚਿਆਂ ਤੋਂ ਪਹੁੰਚ ਤੋਂ ਬਹੁਤ ਦੂਰ ਨੇ ਉਹਨਾਂ ਨੇ ਆਉਣ ਜਾਣ ਦਾ ਵੀ ਬੜਾ ਔਖਾ ਹੈ ਜੇ ਕਈ ਬੱਚਿਆਂ ਦੇ ਜਾਣ ਵੀ ਇੱਛਾ ਰੱਖਣ ਅਤੇ ਔਰ ਪਹੁੰਚ ਵੀ ਜਾਣ ਤਾਂ ਉਹਨਾਂ ਦੀ ਫੀਸਾਂ ਬਹੁਤ ਜ਼ਿਆਦੀਆਂ ਨੇ ਜਿਹਦੇ ਕਰਕੇ ਉਹਨਾਂ ਨੂੰ ਕਾਫੀ ਕਹਿ ਲਓ ਕਿ ਔਖਾਂ ਸਮਾਂ ਵੇਖਣਾ ਪੈਂਦਾ ਹੈ ਅਤੇ ਉਹ ਪਹੁੰਚ ਵੀ ਕਰ ਲੈਣ ਉਹ ਤੋਂ ਬਾਅਦ ਜਾ ਕੇ ਉੱਥੇ ਹੋਰ ਤਰ੍ਹਾਂ ਦੀਆਂ ਜਿਵੇਂ ਆਪਾਂ ਜਾਤ ਪਾਤ ਤੋਂ ਲੈ ਕੇ ਵੀ ਬਹੁਤ ਲੜ੍ਹਾਈਆਂ ਨੇ ਇਹ ਕਾਫੀ ਕੁਛ ਚੇਂਜ ਕਰਨ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਸਰਕਾਰ ਇਹ ਚੀਜ਼ਾਂ ਨੂੰ ਨਹੀਂ ਸੁਧਾਰ ਕਰ ਪਾ ਰਹੀ ਕਿ ਅੱਛੀ ਸਿੱਖਿਆ ਦੇਣ ਲਈ ਅੱਛੀ ਸਿੱਖਿਆ ਵਾਸਤੇ ਵੀ ਘੱਟ ਤੋਂ ਘੱਟ ਫੀਸ ਰੱਖੀ ਜਾਵੇ ਤਾਂ ਕਿ ਹਰ ਵਰਗ ਦਾ ਹਰ ਫਾਈਨੈਸ਼ਲੀ ਤੌਰ ਦੇ ਵਿੱਚ ਹਰ ਬੱਚਾ ਪੜ੍ਹਾਈ ਕਰ ਸਕੇ ਅਤੇ ਆਪਣਾ ਭਵਿੱਖ ਨੂੰ ਵਧੀਆ ਬਣਾ ਸਕੇ